ਜੇ ਭਾਰਤ ਦੀ ਮੀਡੀਆ ਦੀ ਗੱਲ ਕੀਤੀ ਜਾਵੇ ਜਾਂ ਅਖ਼ਬਾਰਾਂ ਦੀ ਗੱਲ ਕੀਤੀ ਜਾਵੇ ਜਾਂ ਨਿਊਜ਼ ਚੈਨਲਾਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਸਮਝਦਾ ਹਾਂ ਵੀ ਸਾਰੇ ਦੇ ਸਾਰੇ ਇਹ ਸੈਂਟਰਲ ਗੌਰਮੈਂਟ ਦੁਆਰਾ ਕ ਕੰਟਰੋਲ ਕੀਤੇ ਜਾਂਦੇ ਹਨ ਜੋ ਸੈਂਟਰਲ ਗੌਰਮੈਂਟ ਨੂੰ ਜਿਵੇਂ ਦੀ ਖਬਰ ਪਸੰਦ ਹੈ ਭਾਰਤ ਮੀਡੀਆ ਉਵੇਂ ਹੀ ਪੇਸ਼ ਕਰਦਾ ਹੈ ਜੇ ਫੈਕਟ ਦੇ ਬੇਸ 'ਤੇ ਗੱਲ ਕੀਤੀ ਜਾਵੇ ਜਾਂ ਜੋ ਵਾਪਰਿਆ ਜਿਵੇਂ ਵਾਪਰਿਆ ਜਿੱਥੇ ਵਾਪਰਿਆ ਜਿੰਨਾ ਵਾਪਰਿਆ ਉਹ ਉਵੇਂ ਦਾ ਹੂ ਬ ਹੂ ਉਹ ਜੋ ਕਲੀਅਰ ਕੱਟ ਪਿਕਚਰ ਨਿਊਜ਼ ਚੈਨਲਾਂ 'ਤੇ ਨਹੀਂ ਦਿਖਾਈ ਜਾਂਦੀ ਸਾਰੇ ਦਾ ਸਾਰਾ ਮੈਨੂਪਲੇਟ ਹੁੰਦਾ ਹੈ ਡਾਟਾ ਜੋ ਵੀ ਖਬਰ ਆਉਂਦੀ ਹੈ ਲੋਕਾਂ ਤੱਕ ਪਹੁੰਚਦੀ ਹੈ ਹੁੰਦਾ ਕੁਛ ਹੈ ਦਿਖਾਇਆ ਕੁਛ ਜਾਂਦਾ ਸਾਰੇ ਦਾ ਸਾਰਾ ਮੀਡੀਆ ਵਿਕਾਊ ਆ ਉਹਦੇ ਵਿੱਚੋਂ ਕੁਛ ਕੁ ਹਾਂ ਕੁਛ ਕੁ ਚੈਨਲ ਨੇ ਕੁਛ ਕੁ ਚੈਨਲ ਨੇ ਕੁਛ ਕੁ ਅਖ਼ਬਾਰ ਨੇ ਜੋ ਸਹੀ ਗੱਲ ਨੂੰ ਤੱਥ ਦੇ ਅਧਾਰ 'ਤੇ ਸਹੀ ਖਬਰ ਨੂੰ ਸਹੀ ਤਰੀਕੇ ਨਾਲ ਦਿਖਾਉਂਦੇ ਵੀ ਨੇ ਬੱਟ ਜ਼ਿਆਦਾਤਰ ਜੋ ਵੀ ਨਿਊਜ਼ ਚੈਨਲ ਨੇ ਅਖ਼ਬਾਰ ਨੇ ਇਹ ਮੈਨੂਪਲੇਟ ਕਰਦੇ ਨੇ ਖਬਰਾਂ ਅਤੇ ਸਹੀ ਤਰੀਕੇ ਤੱਕ ਸਹੀ ਤਰੀਕੇ ਨਾਲ ਲੋਕਾਂ ਤੱਕ ਸਹੀ ਖਬਰ ਨਹੀਂ ਪਹੁੰਚਾਈ ਜਾਂਦੀ ਜੇ ਰਿਸੈਂਟਲੀ ਗੱਲ ਕੀਤੀ ਜਾਵੇ ਤਾਂ ਜੋ ਮਨੀਪੁਰਮ ਦੇ ਵਿੱਚ ਜੋ ਵੀ ਹੋਇਆ ਦੰਗਾ ਫਸਾਦ ਜੋ ਕੁਛ ਵੀ ਹੋਇਆ ਉਹਦਾ ਬਹੁਤ ਘੱਟ ਹਿੱਸਾ ਸੀ ਜੋ ਨਿਊਜ਼ ਚੈਨਲਾਂ 'ਤੇ ਦਿਖਾਇਆ ਗਿਆ ਅਤੇ ਬਾਕੀ ਜੋ ਲੋਕ ਸ਼ੋਸ਼ਲ ਮੀਡੀਆ 'ਤੇ ਚੰਗੇ ਲਿੰਕਾਂ ਦੁਆਰਾ ਜੁੜੇ ਹੋਏ ਨੇ ਉਨ੍ਹਾਂ ਨੂੰ ਤਾਂ ਪਤਾ ਲੱਗ ਰਿਹਾ ਸੀ ਵੀ ਕੀ ਹੋ ਰਿਹਾ ਐਕਚੂਅਲ ਦੇ ਵਿੱਚ ਕੀ ਹੋ ਰਿਹਾ ਕੀ ਨਹੀਂ ਬੱਟ ਜੇ ਨਿਊਜ਼ ਚੈਨਲਾਂ ਦੀ ਗੱਲ ਕੀਤੀ ਜਾਵੇ ਤਾਂ ਨਿਊਜ਼ ਚੈਨਲ ਟੋਟਲੀ ਇਹਦੇ ਬਾਰੇ ਸਾਰੇ ਦੇ ਸਾਰੇ ਸਾਈਲੈਂਟ ਸੀ ਕਿਸੇ ਨੇ ਵੀ ਆਪਦੀ ਪ੍ਰੋਪਰ ਤਰੀਕੇ ਨਾਲ ਸਟੇਟਮੈਂਟ ਨਹੀਂ ਦਿੱਤੀ ਕੋਈ ਵੀ ਅਵਾਜ਼ ਨਹੀਂ ਉਠਾ ਰਿਹਾ ਅਤੇ ਇਹ ਮੇਰੇ ਦੇਸ਼ ਦੀ ਇੱਕ ਤਰ੍ਹਾਂ ਦੀ ਤਰਾਸਦੀ ਹੈਗੀ ਆ ਵੀ ਲੋਕਾਂ ਤੱਕ ਸਹੀ ਖਬਰ ਸਹੀ ਟਾਈਮ 'ਤੇ ਨਹੀਂ ਪਹੁੰਚ ਰਹੀ ਅਤੇ ਮੈਂ ਇਹੀ ਚਾਹੁੰਦਾ ਹੈਗਾ ਵੀ ਜੋ ਨਿਊਜ਼ ਆ ਜਾਂ ਸ਼ੋਸ਼ਲ ਮੀਡੀਆ ਹੈ ਜਾਂ ਅਖ਼ਬਾਰ ਨੇ ਜਾਂ ਨਿਊਜ਼ ਚੈਨਲ ਨੇ ਇਨ੍ਹਾਂ ਨੂੰ ਅਨਵਾਇਸ ਹੋਣਾ ਚਾਹੀਦਾ ਪੱਖਪਾਤ ਰਹਿਤ ਹੋ ਕੇ ਬਿਨਾਂ ਕਿਸੇ ਲਾਲਚ ਬਿਨਾਂ ਕਿਸੇ ਪੈਸੇ ਦੇ ਜਾਂ ਬਿਨਾਂ ਕਿਸੇ ਲਾਲਚ ਦੇ ਜੋ ਖਬਰ ਹੈ ਜਿੰਨੀ ਹੈ ਜਿਵੇਂ ਹੈ ਬਿਨਾਂ ਕਿਸੇ ਦੇ ਫੇਵਰ ਕੀਤੇ ਉਹ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚਾਉਣੀ ਚਾਹੀਦੀ ਹੈ ਐਵੇਂ ਨਹੀਂ ਵਾਪਰਦਾ ਕੁਛ ਇੱਥੇ ਦਿਖਾਇਆ ਕੁਛ ਜਾਂਦਾ ਹੈ ਉਹ ਖਬਰਾਂ ਹੈਗੀਆਂ ਨੇ ਜਦੋਂ ਆਉਂਦੀਆਂ ਨੇ ਲੋਕਾਂ ਦੁਆਰਾ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਅਲੱਗ ਅਲੱਗ ਤਰ੍ਹਾਂ ਦੀਆਂ ਡਾਊਟਸ ਕੰਫਿਊਜਨ ਕਰੇਟ ਕਰਦੀਆਂ ਨੇ ਜਿਹਦੇ ਕਰਕੇ ਕਿ ਬਹੁਤ ਜ਼ਿਆਦਾ ਕੰਫਿਊਜਨ ਪੈਦਾ ਹੁੰਦੀ ਆ ਅਤੇ ਲੋਕ ਜ਼ਿਆਦਾ ਗੁੰਮਰਾਹ ਹੀ ਕੀਤੇ ਜਾਂਦੇ ਆ ਅਤੇ ਇਹ ਇੱਕ ਤਰ੍ਹਾਂ ਦੀ ਤਰਾਸਦੀ ਹੀ ਆ ਜੇ ਕਿਹਾ ਜਾਵੇ ਸਾਡੇ ਸਿਸਟਮ ਦੀ ਜੋ ਸਾਡਾ ਨਿਊਜ਼ ਚੈਨਲ ਹੈ ਜਾਂ ਸਾਡੇ ਸ਼ੋਸ਼ਲ ਮੀਡੀਆ ਜਿਨ੍ਹਾਂ ਦੇ ਸਿਰ 'ਤੇ ਜ਼ਿੰਮੇਵਾਰੀ ਹੈ ਜੋ ਵੀ ਖਬਰਾਂ ਨੂੰ ਪਹੁੰਚਾਉਣ ਦਾ ਜਾਣਕਾਰੀ ਨੂੰ ਦਾ ਅਦਾਨ ਪ੍ਰਦਾਨ ਕਰਨ ਦਾ ਅਤੇ ਇਹਦੇ ਬਾਰੇ ਇਹੀ ਕੁਛ ਕਿਹਾ ਜਾ ਸਕਦਾ ਥੈਂਕਿ ਊ ਸੋ ਮੱਚ